ਹਾਂਜੀ ਓਲਾ ਕੈਬ ਤੋਂ ਬੋਲ ਰਹੇ ਜੀ ਹਾਂਜੀ ਸਰ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਸ਼ਿਕਾਇਤ ਕਰਨੀ ਸੀ ਅਸੀਂ ਆਪਣੇ ਸਾਰੇ ਪਰਿਵਾਰ ਦੇ ਨਾਲ ਕੁੱਲੂ ਜਾਣ ਵਾਸਤੇ ਸੈਰ ਵਾਸ ਸੈਰ ਸਪਾਟੇ ਵਾਸਤੇ ਘੁੰਮਣ ਵਾਸਤੇ ਕੁੱਲੂ ਜਾਣ ਵਾਸਤੇ ਤੁਹਾਡੀ ਕੈਬ ਬੁੱਕ ਕਰਵਾਈ ਸੀ ਅਤੇ ਅਸੀਂ ਸਵੇਰੇ ਜਲਦੀ ਜਾਣਾ ਹੈ ਅਤੇ ਅਸੀਂ ਕੈਬ ਬੁੱਕ ਹੋਈ ਸੀ ਪਰ ਹੁਣ ਉਹ ਜਿਹੜਾ ਤੁਹਾਡਾ ਡਰਾਈਵਰ ਆ ਉਹ ਸਾਡੀ ਕਾਲ ਨਹੀਂ ਚੁੱਕ ਰਿਹਾ ਉਹਦਾ ਫੋਨ ਜਿਹੜਾ ਵਾ ਉਹ ਪਹੁੰਚ ਤੋਂ ਬਾਹਰ ਆ ਰਿਹਾ ਅਤੇ ਹੁਣ ਦੱਸੋ ਵੀ ਅਸੀਂ ਹੁਣ ਕੀ ਕਰੀਏ ਅਸੀਂ ਸਾਰੀ ਤਿਆਰੀ ਕਰਕੇ ਬੈਠੇ ਹੋਏ ਹਾਂ ਅਤੇ ਹੁਣ ਉਹ ਫੋਨ ਨਹੀਂ ਚੁੱਕ ਰਿਹਾ ਹੁਣ ਉਹਦੇ ਫੋਨ ਚੁੱਕਣ ਦਾ ਤਾਂ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਅਤੇ ਉਹ ਪਰੇਸ਼ਾਨੀ ਤੋਂ ਇਲਾਵਾ ਹੁਣ ਤੁਸੀਂ ਸਾਡਾ ਪਰੇਸ਼ਾਨੀ ਦਾ ਹੱਲ ਕਰ ਸਕਦੇ ਜੇ ਜੇ ਤੁਸੀਂ ਉਹਦੀ ਜਗ੍ਹਾ ਕੋਈ ਹੋਰ ਕੋਈ ਕੈਬ ਭੇਜ ਸਕਦੇ ਜੇ ਜੇ ਨਹੀਂ ਭੇਜ ਸਕਦੇ ਤਾਂ ਤੁਹਾਡੀ ਰੈਪੂਟੇਸ਼ਨ ਦੇ ਵਿੱਚ ਫਰਕ ਪਊਗਾ ਤੁਹਾਨੂੰ ਪਤਾ ਹੀ ਤੁਹਾਡੇ ਮਾਨ ਸਨਮਾਨ ਦੇ ਵਿੱਚ ਫਰਕ ਪਵੇਗਾ ਅਤੇ ਕਿਰਪਾ ਕਰਕੇ ਜਾਂ ਤਾਂ ਤੁਸੀਂ ਉਸੇ ਡਰਾਈਵਰ ਨੂੰ ਭੇਜ ਦਿਓ ਅਤੇ ਜਾਂ ਕੋਈ ਸਾਡੇ ਵਾਸਤੇ ਨਵੀਂ ਗੱਡੀ ਦਾ ਇੰਤਜ਼ਾਮ ਕਰੋ ਤਾਂ ਕਿ ਸਾਡੀ ਮੁਸ਼ਕਿਲ ਦਾ ਜਿਹੜਾ ਵਾ ਉਹ ਜਲਦੀ ਤੋਂ ਜਲਦੀ ਹੱਲ ਹੋ ਸਕੇ ਧੰਨਵਾਦ ਜੀ